ਰੇਲ ਗੱਡੀ ਇੱਕ ਬਹੁਤ ਵਧੀਆ ਸਾਧਨ ਹੈ ਜਿਸ ਨਾਲ ਅਸੀਂ ਅਸੀਂ ਲੰਮੇ ਟੂਰ 'ਤੇ ਜਾ ਕੇ ਚਲੇ ਜਾਦੇ ਹਾਂ ਇਸ ਗੱਡੀ ਦਾ ਸ਼ੋਰ ਸ਼ਰਾਬੇ ਨਾਲੋਂ ਬੱਸਾਂ ਨਾਲੋਂ ਬਹੁਤ ਵਧੀਆ ਸਫ਼ਰ ਹੁੰਦਾ ਹੈ ਬਹੁਤ ਸਫ਼ਰ ਹੁੰਦਾ ਹੈ ਇਸ ਕਰਕੇ ਅਸੀਂ ਇਸ ਦੇ ਇਸਦੀ ਟਿਕਟ ਵੀ ਘੱਟ ਹੁੰਦੀ ਹੈ ਇਸ ਰਾਹੀਂ ਇਸ ਤੋਂ ਅਸੀਂ ਦਿੱਲੀ ਤੋਂ ਬਠਿੰਡੇ ਤੋਂ ਦਿੱਲੀ ਆਗਰਾ ਦਾ ਸਫ਼ਰ ਕਰਕੇ ਹਜ਼ੂਰ ਸਾਹਿਬ ਚਲੇ ਗਏ ਅਸੀਂ ਮੁਕਤਸਰ ਦੇ ਵਾਸੀ ਹਾਂ ਅਸੀਂ ਹਜਜ਼ੂਰ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਾਨੂੰ ਉੱਥੇ ਬਹੁਤ ਵਧੀਆ ਲੱਗਿਆ ਆਉਣ ਜਾਣ ਫਿਰ ਗੱਡੀ ਦਾ ਹੀ ਸਫ਼ਰ ਕੀਤਾ ਬਹੁਤ ਵਧੀਆ ਲੱਗੀ ਲੱਗਿਆ ਬਹੁਤ ਵਧੀਆ ਸੀਟਾਂ ਦਾ ਪ੍ਰਬੰਧ ਗੱਡੀ ਵਿੱਚ ਸਾਨੂੰ ਮਿਲਿਆ ਇਸ ਲਈ ਅਸੀਂ ਬਹੁਤ ਵਧੀਆ ਸਫ਼ਰ ਕਰ ਲਿਆ